ਹਾਂਜੀ ਇੱਥੇ ਹੀ ਸੈਲਾਨੀ ਅਕਰਸ਼ਣ ਹਨ ਜੋ ਕਿ ਭਾਈਚਾਰੇ ਨੂੰ ਵਧਾ ਸਕਦੇ ਹਾਂ ਜਿਵੇਂ ਕਿ ਆਪਾਂ ਇੱਥੇ ਦਰਬਾਰ ਸਾਹਿਬ ਹੈ ਨਾ ਜਿਹੜਾ ਕਿ ਗੁਰਦੁਆਰਾ ਇਹ ਜਿਹੜਾ ਪਾਣੀ ਵਿੱਚ ਸਥਿਤ ਗੁਰਦੁਆਰਾ ਹੈਗਾ ਉਹ ਇੱਕ ਬਹੁਤ ਹੀ ਮੁੱਖ ਆਕਰਸ਼ਣ ਹੈ ਪੂਰੀ ਦੁਨੀਆ ਦੇ ਵਿੱਚ ਲੋਕ ਤਾਂ ਦੂਰੋਂ ਦੂਰੋਂ ਦੇਖਣ ਆਉਂਦੇ ਹਨ ਦੂਸਰੇ ਦੂਸਰੇ ਦੇਸ਼ਾਂ 'ਚੋਂ ਵੀ ਦੇਖਣ ਆਉਂਦੇ ਹਨ ਅਤੇ ਇਸ ਦੇ ਨਾਲ ਕਿ ਭਾਈਚਾਰਾ ਵੱਧਦਾ ਹੈ ਜਿਵੇਂ ਕਿ ਤੁਸੀਂ ਹੁਣ ਅਕਸਰ ਆਪਣੇ ਪੰਜਾਬ ਦੇ ਲੋਕ ਬਾਹਰ ਜਾਂਦੇ ਆ ਸ਼੍ਰੀਨਗਰ ਜਾਂ ਜੰਮੂ ਕਸ਼ਮੀਰ ਘੁੰਮਣ ਜਾਂਦੇ ਆ ਕਿਉਂਕਿ ਉੱਥੇ ਦੀ ਬਿਊਟੀ ਆ ਉੱਥੇ ਦੀ ਖੂਬਸੂਰਤੀ ਨੂੰ ਵੇਖਣ ਜਾਂਦੇ ਆ ਉਹ ਇੱਕ ਟੂਰਿਸਟ ਇੱਕ ਹੈ ਨਾ ਪ੍ਰਸਿੱਧ ਇੱਕ ਟੂਰਿਸਟ ਪਲੇਸ ਹੈਗੀ ਆ ਇਹਦੇ ਨਾਲ ਕੀ ਹੁੰਦਾ ਆਪਸੀ ਜਿਹੜਾ ਹੈਗਾ ਉਹ ਪਿਆਰ ਵੱਧਦਾ ਹੈ ਲੋਕ ਇੱਕ ਦੂਜੇ ਦੇ ਸਟੇਟਾਂ ਵਿੱਚ ਦੇਸ਼ਾਂ ਵਿੱਚ ਬਾਹਰ ਵਿਦੇਸ਼ਾਂ ਵਿੱਚ ਜਾਂਦੇ ਆ ਹੈ ਨਾ ਆਪਣੇ ਪੰਜਾਬ ਵਿੱਚ ਸੈਰ ਸਪਾਟੇ ਦੀਆਂ ਬਹੁਤ ਸਾਰੀਆਂ ਜਗ੍ਹਾਵਾਂ ਹਨ ਜਿਵੇਂ ਕਿ ਅਨੰਦਪੁਰ ਸਾਹਿਬ ਹੋ ਗਿਆ ਅੰਮ੍ਰਿਤਸਰ ਸਾਹਿਬ ਹੋ ਗਿਆ ਹੈ ਨਾ ਹੋਰ ਮੁਕਤਸਰ ਸਾਹਿਬ ਹੋ ਗਿਆ ਫਰੀਦਕੋਟ ਹੋ ਗਿਆ ਹੈ ਨਾ ਜਿੱਥੇ ਕਿ ਬਹੁਤ ਹੀ ਤਰ੍ਹਾਂ ਦੇ ਸਾਨੂੰ ਮਿਊਜਿਅਮ ਪਾਰਕਾਂ ਗੁਰਦੁਆਰੇ ਮਸਜਿਦਾਂ ਆਦਿ ਹੀ ਬਹੁਤ ਹੀ ਆਕਰਸ਼ਣ ਦੇ ਕੇਂਦਰ ਹਨ ਹੈ ਨਾ ਜਿਹੜੇ ਕਿ ਸਾਡੇ ਭਾਈਚਾਰੇ ਜਾਂ ਸੈਰ ਸਪਾਟੇ ਵਧਾਉਂਦੇ ਹਨ ਇੱਥੇ ਹੁਣ ਪਠਾਨਕੋਟ ਦੇ ਵਿੱਚ ਇੱਕ ਮਿੰਨੀ ਗੋਆ ਹੈ ਨਾ ਉਹ ਇੱਕ ਲੇਕ ਦਾ ਵਿਊ ਰਿਵਰ ਵਿਊ ਹੈਗਾ ਆ ਹੈ ਨਾ ਜਿਹੜਾ ਬਹੁਤ ਹੀ ਫੇਮਸ ਹੈਗਾ ਜਿਹਨੂੰ ਵੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ